ਹਾਂਜੀ ਹੈੱਡਫ਼ੋਨ ਨਾ ਹੈ ਤਾਂ ਬਹੁਤ ਵਧੀਆ ਚੀਜ਼ ਆ ਪਰ ਅਸੀਂ ਇਹਦੀ ਵਰਤੋਂ ਜਿਹੜੀ ਉਹ ਬਹੁਤ ਕੁਛ ਅੱਛੀ ਤਰ੍ਹਾਂ ਨਹੀਂ ਕਰਦੇ ਇਹਨੂੰ ਧਿਆਨ ਨਾਲ਼ ਸਾਨੂੰ ਵਰਤਣਾ ਚਾਹੀਦਾ ਏ ਜਿਵੇਂ ਘਰਾਂ 'ਚ ਵੀ ਦੇਖ ਲਉ ਤੁਸੀਂ ਬੱਚੇ ਆਪਣੇ ਕੰਨਾਂ 'ਚ ਲਾ ਲੈਂਦੇ ਆ ਅਤੇ ਘਰ ਕੋਈ ਵੀ ਅਵਾਜ਼ਾਂ ਮਾਰਦੇ ਰਹੋ ਕੁਛ ਨਹੀਂ ਸੁਣਦੇ ਨਾ ਪਤਾ ਚੱਲਦਾ ਉਨ੍ਹਾਂ ਨੂੰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਅਤੇ ਬਾਹਰ ਜਾਓ ਤਾਂ ਬਾਹਰ ਵੀ ਸੈਰ ਕਰਦੇ ਲੋਕਾਂ ਨੇ ਕੰਨਾਂ 'ਚ ਲਗਾਏ ਹੁੰਦੇ ਆ ਸਾਈਕਲ 'ਤੇ ਚੱਲਦੇ ਹੋਏ ਸ ਕੰਨਾਂ 'ਚ ਲਗਾ ਲੈਂਦੇ ਆ ਅਤੇ ਬਾਈਕ 'ਤੇ ਵੀ ਰੋਡ ਦੇ ਵਿੱਚ ਜਿੰਨੇ ਐਕਸੀਡੈਂਟ ਕਈ ਵਾਰੀ ਇਹਦੇ ਨਾਲ਼ ਹੀ ਹੁੰਦੇ ਹੈ ਕੰਨਾਂ 'ਚ ਲਗਾਏ ਹੁੰਦੇ ਹੈ ਅਤੇ ਕੋਈ ਅਵਾਜ਼ ਨਹੀਂ ਸੁਣਦਾ ਹੈਗਾ ਪਏ ਹੌਰਨ ਮਾਰੀ ਜਾਉ ਜੋ ਵੀ ਕਰੀ ਜਾਉ ਅਤੇ ਪਰ ਇਹਨਾਂ ਦੀ ਵਰਤੋਂ ਆ ਜਿਹੜੀ ਸਾਨੂੰ ਉਹ ਧਿਆਨ ਨਾਲ਼ ਕਰਨੀ ਚਾਹੀਦੀ ਆ ਆਪਾਂ ਬਹੁਤ ਗਲਤ ਤਰੀਕੇ ਨਾਲ਼ ਵਰਤਦੇ ਹਾਂ ਇਹਨੂੰ ਇਹਦਾ ਸਾਨੂੰ ਸਹੀ ਵਰਤੋਂ ਕਰਨੀ ਚਾਹੀਦੀ ਹੈ